ਹੈਲੋ ਹਾਂਜੀ ਹਾਂਜੀ ਠੀਕ ਆ ਜੀ ਅੱਛਾ ਅੱਛਾ ਜੀ ਠੀਕ ਹੈ ਤੁਸੀਂ ਕਪੂਰਥਲਾ ਆ ਰਹੇ ਹੋ ਅੱਛਾ ਠੀਕ ਹੈ ਜੀ ਇੱਥੇ ਬਹੁਤ ਜ਼ਿਆਦਾ ਵਾ ਜਿੱਦਾਂ ਲਾਈਕ ਰਮਾਡਾ ਹੋ ਗਿਆ ਨਟਰਾਜ ਹੋ ਗਿਆ ਔਰ ਸਲੈਂਡਨ ਹੋਟਲ ਹੋ ਗਿਆ ਔਰ ਔਰ ਗਾਂਧੀ ਹੋ ਹੋਟਲ ਹੋ ਗਿਆ ਇੱਧਰ ਇਹ ਇਹੀ ਫੇਮਸ ਨੇ ਜ਼ਿਆਦਾਤਰ ਰਮਾਡਾ ਤਾਂ ਬਹੁਤ ਜ਼ਿਆਦਾ ਫੇਮਸ ਮਤਲਬ ਨੰਬਰ ਵੰਨ 'ਤੇ ਰਮਾਡਾ ਆਉਂਦਾ ਹਰ ਚੀਜ਼ ਦਾ ਪ੍ਰਾਈਜ ਵੀ ਸਹੀ ਆ ਔਰ ਸਫ਼ਾਈ ਵਗੈਰਾ ਵੀ ਬਹੁਤ ਸਹੀ ਆ ਇਹਨਾਂ ਦੀ ਤੁਹਾਨੂੰ ਕੋਈ ਗੰਦਗੀ ਨਹੀਂ ਨਜ਼ਰ ਆਏਗੀ ਸਰਵਿਸ ਵੀ ਬਹੁਤ ਵਧੀਆ ਵਾ ਨਹੀਂ ਨਹੀਂ ਪਿਓਰ ਵੈਜ਼ੀਟੇਰੀਅਨ ਹਾਂਜੀ ਹਾਂਜੀ ਹਾਂਜੀ ਉਹ ਵੀ ਅਵੇਲੇਬਲ ਹੈਗੀ ਆ ਇਹਨਾਂ ਕੋਲ ਹਾਂਜੀ ਹਾਂਜੀ ਹਾਂਜੀ ਬਿਲਕੁਲ ਫਰੈੱਸ਼ ਹੁੰਦਾ ਓਕੇ ਉਹ ਤੁਹਾਡੇ ਸਾਹਮਣੇ ਵੀ ਕੁਕਿੰਗ ਕਰ ਸਕਦੇ ਆ ਜੇ ਤੁਹਾਨੂੰ ਮਤਲਬ ਕੋਈ ਸ਼ੱਕ ਵਗੈਰਾ ਹੋਵੇ ਹਾਂਜੀ ਹਾਂਜੀ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਉਹਨਾਂ ਦਾ ਹੋਲ ਵਗੈਰਾ ਸਭ ਬਹੁਤ ਵਧੀਆ ਹੁੰਦਾ ਵੱਡਾ ਹੁੰਦਾ ਆ ਮਿਊਜ਼ਿਕ ਸਿਸਟਮ ਵੀ ਬਹੁਤ ਵਧੀਆ ਹਾਂਜੀ ਸਟੇਜ ਵੀ ਬਣੇ ਸਟੇਜ ਵੀ ਬਣੀ ਹੁੰਦੀ ਆ ਉਹਦੇ 'ਤੇ ਡਾਂਸ ਵਗੈਰਾ ਸਭ ਕਰ ਸਕਦੇ ਹੋ ਹਾਂਜੀ ਕਰ ਸਕਦੇ ਹੋ ਰਮਾਡਾ ਹੀ ਬੈਸਟ ਓਪਸ਼ਨ ਹੈਗੀ ਆ ਹਾਂਜੀ ਹਾਂਜੀ ਜ਼ਰੂਰ ਕਰਦੀ ਠੀਕ ਹੈ ਓਕੇ